ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਉਰੇ ਪਟਿਆਲੇ ਤੋਂ ਬੋਲਦੀ ਹਾਂ ਬਲਜਿੰਦਰ ਜੀ ਸਿਸਟਰ ਅਤੇ ਤੁਹਾਨੂੰ ਯਾਦ ਹੈ ਬਲਜਿੰਦਰ ਹਾਂ ਹਾਂ ਹਾਂ ਹਾਂ ਹਾਂ ਮੋਹਾਲੀ ਪੜ੍ਹ ਕੇ ਗਏ ਤੁਹਾਡੇ ਕੋਲ ਮੈਂ ਉਹਨਾਂ ਦੀ ਭੈਣ ਬੋਲਦੀ ਹਾਂ ਉਹ ਨਾ ਮੈਂ ਐਡਮਿਸ਼ਨ ਲਈ ਹੈ ਇੱਥੇ ਮੋਹਾਲੀ ਕੋਲਜ 'ਚ ਅਤੇ ਤੁਸੀਂ ਮੈਨੂੰ ਪੀ ਜੀ ਦਵਾਉਣ 'ਚ ਮੇਰੀ ਮਦਦ ਕਰੋ ਹਾਂ ਹਾਂ ਹਾਂ ਹਾਂ ਠੀਕ ਹੈ ਹਾਂ ਫਿਰ ਉਹਦੀਆਂ ਫੈਸਿਲੀਟੀਜ਼ ਦੱਸੋ ਵੇਖੋ ਮੈਂ ਨਾ ਥੋੜ੍ਹੀ ਜਿਹੀ ਉਹ ਹੈ ਵੀ ਮੈਨੂੰ ਹਰੇਕ ਚੀਜ਼ ਵਧੀਆ ਹੀ ਚਾਹੀਦੀ ਹੈ ਹਾਂ ਮੈਨੂੰ ਪਹਿਲਾਂ ਤੁਸੀਂ ਫੈਸਿਲੀਟੀਜ਼ ਦੱਸੋ ਅੱਛਾ ਜੀ ਹਾਂ ਉਹ ਜ਼ਰੂਰੀ ਹੈ ਚੱਲੋ ਉਹ ਵੀ ਠੀਕ ਹੈ ਹਾਂ ਹਾਂਜੀ ਹਾਂ ਠੀਕ ਹਾਂ ਹਾਂ ਮੈਨੂੰ ਤਾਂ ਹੀ ਤਾਂ ਤੁਹਾਡਾ ਨੰਬਰ ਦਿੱਤਾ ਉਹਨਾਂ ਨੇ ਯਕੀਨ ਦੇ ਨਾਲ ਹਾਂ ਚੱਲੋ ਠੀਕ ਹੈ ਫਿਰ ਤੁਸੀਂ ਵਿਹਲੇ ਹੋ ਠੀਕ ਹੈ ਜੀ ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ